ਅੱਜ ਕੱਲ੍ਹ ਲੋਕ ਪੰਜਾਬੀ ਨੂੰ ਭੁੱਲ ਕੇ ਵਿਦੇਸ਼ੀ ਭ ਭਾਸ਼ਾਵਾਂ ਵੱਲ ਭੱਜਦੇ ਜਾ ਰਹੇ ਹਨ ਉਹ ਪੰਜਾਬੀ ਨੂੰ ਘੱਟ ਮਹੱਤਵ ਦਿੰਦੇ ਹਨ ਅਤੇ ਇਸਨੂੰ ਬਚਾਏ ਰੱਖਣ ਦੇ ਲਈ ਸਾਨੂੰ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਇਸ ਨੂੰ ਜਿਉਂਦਾ ਰੱਖਣਾ ਹੀ ਸਾਡੇ ਲਈ ਸਭ ਤੋਂ ਜ਼ਰੂਰੀ ਹੈ ਹੁਣ ਪੰਜਾਬ ਵਿੱਚ ਸਾਨੂੰ ਚਾਹੀਦਾ ਹੈ ਕਿ ਸਾਨੂੰ ਹਰੇਕ ਇੱਕ ਵਿਅਕਤੀ ਨੂੰ ਪੰਜਾਬੀ ਲਈ ਜਾਗਰੂਕ ਕਰਨਾ ਚਾਹੀਦਾ ਹੈ ਜਿਵੇਂ ਕਿ ਸਾਡੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਈ ਸਾਰੀਆਂ ਯੋਜਨਾਵਾਂ ਰਾਹੀਂ ਲੋਕਾਂ ਨੂੰ ਪੰਜਾਬੀ ਲਈ ਜਾਗਰੂਕ ਕਰ ਰਹੀ ਹੈ